ਦੌੜਦੇ ਸਮੇਂ ਮੈਂ ਚੱਕਵੇਂ ਗਾਣੇ ਸੁਣਨਾ ਪਸੰਦ ਕਰਦਾ ਹਾਂ ਜਿਵੇਂ ਕਿ ਸਿੱਧੂ ਮੂਸੇ ਵਾਲੇ ਦੇ ਗੀਤ ਹੋਣ ਜਾਂ ਹਰਦੀਪ ਗਰੇਵਾਲ ਦੇ ਗੀਤ ਹੁਣ ਜਿਨ੍ਹਾਂ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਹੈ ਗੀਤ ਸੁਣਨ ਅਤੇ ਦੌੜ ਦੇ ਸਮੇਂ ਗੀਤ ਸੁਣਨ ਨਾਲ ਸਾਨੂੰ ਇੱਕ ਤਰੀਕੇ ਦਾ ਦਾ ਕੁਝ ਦੌੜਦੇ ਸਮੇਂ ਸਾਨੂੰ ਕੁਝ ਪਤਾ ਨਹੀਂ ਰਹਿੰਦਾ ਹੈਗਾ ਅਤੇ ਅਸੀਂ ਸਾਡਾ ਧਿਆਨ ਸਿਰਫ਼ ਸੋਂਗ ਵੱਲ ਹੁੰਦਾ ਹੈ ਜਿਹਦੇ ਨਾਲ ਸਾਨੂੰ ਇੱਕ ਤਰ੍ਹਾਂ ਦੀ ਮੋਟੀਵੇਸ਼ਨ ਮਿਲਦੀ ਹੈ ਜਿਹਦੇ ਨਾਲ ਸਸ ਅਸੀਂ ਦੌੜਦੇ ਹੀ ਰਹਿੰਦੇ ਹਾਂ ਅਤੇ ਅਗਰ ਅਸੀਂ ਗੀਤ ਨਹੀਂ ਸੁਣਦੇ ਹਾਂ ਤਾਂ ਸ ਅਸੀਂ ਆਪਣਾ ਇੱਕ ਗੋਲ ਲੈ ਕੇ ਚਲਦੇ ਹਾਂ ਵੀ ਜੋ ਅਸੀਂ ਕਾਮਯਾਬ ਹੋਣਾ ਹੈ ਕਿਸੇ ਵੀ ਫੀਲਡ ਵਿੱਚ ਜਿਵੇਂ ਕਿ ਅਸੀਂ ਭਰਤੀ ਦੀ ਆਰਮੀ ਵਿੱਚ ਭਰਤੀ ਦੀ ਤ ਤਿਆਰੀ ਲਈ ਦੌੜ ਲਗਾਉਂਦੇ ਹਾਂ ਤਾਂ ਸਾਂਡਾ ਉਹ ਇੱਕ ਗੋਲ ਗੋਲ ਹੁੰਦਾ ਹੈ ਹੈ ਜਿਸ ਨੂੰ ਅਸੀਂ ਪਾਉਣ ਲਈ ਦਿਨ ਰਾਤ ਮਿਹਨਤ ਕਰਦੇ ਹਾਂ ਇਸ ਲਈ ਸਾਡਾ ਧਿਆਨ ਸਿਰਫ਼ ਉਸ ਗੋਲ ਵੱਲ ਹੀ ਰਹਿੰਦਾ ਹੈ ਅਤੇ ਅਸੀਂ ਉਹ ਸੋਚਦੇ ਸੋਚਦੇ ਦੌੜ ਲਗਾਉਂਦੇ ਹਾਂ ਕਿ ਅਸੀਂ ਉਸ ਮੰਜ਼ਿਲ ਤੱਕ ਕਿਵੇਂ ਪਹੁੰਚਣਾ ਹੈ ਅਸੀਂ ਉਸ ਉੱਥੇ ਉਸ ਨੂੰ ਕਿਵੇਂ ਕ੍ਰੋਸ ਕਰਨਾ ਹੈ ਇਸ ਲਈ ਅਸੀਂ ਗਾਣੇ ਸੁਣਨ ਤੋਂ ਬਗੈਰ ਸਾਡਾ ਧਿਆਨ ਉਸ ਮੰਜ਼ਿਲ ਵੱਲ ਹੁੰਦਾ ਹੈ ਅਤੇ ਅਸੀਂ ਆ ਆਪਣੇ ਤਨ ਦੇਹੀ ਨਾਲ ਉਸ ਕੰਮ ਨੂੰ ਕਰਦੇ ਹਾਂ ਅਤੇ ਦੌੜ ਲਗਾਉਣ ਨਾਲ ਸਰੀਰ ਘੱਟਦਾ ਹੈ ਅਤੇ ਅਤੇ ਤੰਦਰੁਸਤ ਬੰਦਾ ਰਹਿੰਦਾ ਹੈ ਇਸ ਨਾਲ ਸਾਡੇ ਸਰੀਰ ਨੂੰ ਊਰਜਾ ਪ੍ਰਾਪਤ ਹੁੰਦੀ ਹੈ ਅਤੇ